ਤਰਨ ਤਾਰਨ ਪੰਜਾਬ ਵਿੱਚ ਸਥਿਤ ਇੱਕ ਇਤਿਹਾਸਿਕ ਸ਼ਹਿਰ ਹੈ ਇਸਨੂੰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ ਹੈ ਇਸਨੂੰ ਸਿੱਖ ਇਤਿਹਾਸ ਵਿੱਚ ਖਾਸ ਦਰਜਾ ਹਾਸਿਲ ਹੈ ਇਹੋ ਦੁੱਖ ਨਿਵਾਰਨ ਦੇ ਨਾਂ ਨਾਲ ਵੀ ਪ੍ਰਸਿੱਧ ਹੈ ਇਸ ਸ਼ਹਿਰ ਦੀ ਨੀਂਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਰੱਖੀ ਗਈ ਸੀ ਗੁਰੂ ਅਰਜਨ ਦੇਵ ਜੀ ਨੇ ਪਲਾਸੋ ਦੇ ਪਿੰਡਾਂ ਦੀ ਜ਼ਮੀਨ ਖਰੀਦ ਕੇ ਸਤਾਰ੍ਹਾਂ ਵੈਸਾਖ ਸਨਮਤ ਸੋਲ਼੍ਹਾਂ ਸੋਲ਼੍ਹਾਂ ਚਾਰ ਸੱਤ ਵਿੱਚ ਇੱਕ ਧਾਰਮਿਕ ਕੇਂਦਰ ਦੇ ਸਰੋਵਰ ਦੀ ਖੁਦ ਖੁਦਵਾਈ ਸ਼ੁਰੂ ਕਰਵਾਈ ਅਤੇ ਚਾਰ ਚੇਤ ਸਨਮਤ ਸੋਲ਼੍ਹਾਂ ਪੰਜ ਤਿੰਨ ਨੂੰ ਇਤਿਹਾਸ ਨਗਰ ਦੀ ਨੀਂਹ ਰੱਖੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਗੋਬਿੰਦ ਪਾਤਸ਼ਾਹ ਨੇ ਵੀ ਇਸ ਸਥਾਨ 'ਤੇ ਆਪਣੇ ਚਰਨ ਪਾਏ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਅਜੇ ਚੱਲ ਹੀ ਰਹੀ ਸੀ ਕਿ ਸਰਾਏ ਨੂੰ ਦੀਨ ਦੀ ਉਸਾਰੀ ਸਰਕਾਰੀ ਤੌਰ ਤੋਂ ਸ਼ੁਰੂ ਹੋ ਗਈ ਸਾਡੇ ਤਰਨ ਤਾਰਨ ਵਿੱਚ ਦਰਬਾਰ ਸਾਹਿਬ ਵੀ ਹੈ ਜਿੱਥੇ ਲੋਕ ਰੋਜ਼ ਮੱਥਾ ਟੇਕਣ ਆਉਦੇ ਹਨ ਇਹ ਥਾਂ ਬਹੁਤ ਹੀ ਪ੍ਰਸਿੱਧ ਹੈ ਜਿੱਥੇ ਲੋਕ ਆਉਂਦੇ ਹਨ ਅਤੇ ਇਹ ਲੋਕਾਂ ਲਈ ਹਮੇਸ਼ਾਂ ਖੁੱਲ੍ਹੀ ਰਹਿੰਦੀ ਹਾਂ ਇੱਥੇ ਲੋਕ ਹਮੇਸ਼ਾਂ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਅਰਦਾਸ ਕਰਦੇ ਹਨ ਇੱਥੇ ਲੰਗਰ ਵੀ ਮਿਲਦਾ ਹੈ ਇਹ ਤਰਨ ਤਾਰਨ ਦੀ ਬਹੁਤ ਹੀ ਪ੍ਰਸਿੱਧ ਜਗ੍ਹਾ ਹੈ ਇੱਥੇ ਲੋਕ ਰੋਜ਼ ਮੱਥਾ ਟੇਕਣ ਆਉਂਦੇ ਹਨ ਕੋਈ ਇੱਥੇ ਸਵੇਰੇ ਸ਼ਾਮ ਦੁਪਹਿਰੇ ਲੋਕ ਇੱਥੇ ਜਦ ਮਰਜ਼ੀ ਮੱਥਾ ਟੇਕਣ ਲਈ ਆ ਸਕਦੇ ਹਨ ਇਸ ਕਰਕੇ ਮੈਨੂੰ ਤਰਨ ਤਾਰਨ ਵਿੱਚ ਦਰਬਾਰ ਸਾਹਿਬ ਬਹੁਤ ਹੀ ਪਸੰਦ ਹੈ ਇਸ ਕਰਕੇ ਮੈਂ ਵੀ ਇੱਥੇ ਰੋਜ਼ ਮੱਥਾ ਟੇਕਣ ਜਾਂਦੀ ਹਾਂ ਅਤੇ ਅਰਦਾਸ ਕਰਦੀ ਹਾਂ ਅਤੇ ਇੱਥੇ ਅਰਦਾਸ ਕਰਨ ਨਾਲ ਬਹੁਤ ਹੀ ਲੋਕਾਂ ਦੇ ਸੁਪਨੇ ਵੀ ਪੂਰੇ ਹੁੰਦੇ ਹਨ ਅਤੇ ਭਗਵਾਨ ਉਹਨਾਂ ਦੀ ਬਹੁਤ ਹੀ ਸੁਣਦਾ ਹੈ ਇਸ ਕਰਕੇ ਮੈਨੂੰ ਤਰਨ ਤਾਰਨ ਵਿੱਚ ਦਰਬਾਰ ਸਾਹਿਬ ਬਹੁਤ ਹੀ ਪਸੰਦ ਹੈ ਅਤੇ ਇਹ ਲੋਕਾਂ ਲਈ ਹਮੇਸ਼ਾਂ ਖੁੱਲ੍ਹਿਆ ਰਹਿੰਦਾ ਹੈ ਅਤੇ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ ਧੰਨਵਾਦ